ਸਤਿ ਸ਼੍ਰੀ ਅਕਾਲ ਮੇਰਾ ਨਾਂ ਅਰਮਾਨਦੀਪ ਸਿੰਘ ਹੈ ਮੈਂ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਮੈਂ ਤੁਹਾਡੇ ਨਾਲ ਡੀਜ਼ੀ ਲੋਕਰ ਸੰਬੰਧੀ ਗੱਲ ਕਰਨੀ ਚਾਹੁੰਦਾ ਹਾਂ ਕਿ ਮੇਰੇ ਸਾਰੇ ਪਰੂਫ ਡੀਜ਼ੀ ਲੋਕਰ ਵਿੱਚ ਸਹੀ ਹਨ ਮੇਰੇ ਡੀਜ਼ੀ ਲੋਕਰ ਵਿੱਚ ਪ੍ਰੂ ਪ੍ਰੂਫ ਸੇਫ ਹਨ ਕੀ ਮੈਂ ਇਹਨਾਂ ਮੈਂ ਨਾ ਆਪਣਾ ਡੀਜ਼ੀ ਲੋਕਰ ਦਾ ਪਾਸਵਰਡ ਚੇਂਜ ਕਰਨਾ ਚਾਹੁੰਦਾ ਹਾਂ ਮੈ ਮੇਰੇ ਕੋਲੋਂ ਗਲਤੀ ਨਾਲ ਮੇਰੇ ਫਰੈਂਡ ਸਾਹਮਣੇ ਪਾਸਪੋਰਟ ਰੱਖਿਆ ਗਿਆ ਸੀ ਜਿਸ ਕਾਰਨ ਹੁਣ ਮੈਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ ਕਿ ਮੈਂ ਇਸ ਨੂੰ ਕਿਸੇ ਹੋਰ ਗਲਤ ਹੱਥਾਂ ਵਿੱਚ ਨਾ ਪਾ ਸਕਾਂ ਇਹ ਡਿਜ਼ੀ ਲੋਕਰ ਡਿਜ਼ੀ ਲੋਕਰ ਕੋਈ ਮੇਰਾ ਫਰੈਂਡ ਵੀ ਮੇਰਾ ਜੂਸ ਕਰ ਸਕਦਾ ਉਸ ਨੂੰ ਮੇਰੀ ਪੂਰੀ ਡਿਟੇਲ ਹੈ ਡੀਜ਼ੀ ਲੋਕਰ ਬਾਰੇ ਉਸਨੂੰ ਮੇਰਾ ਨਾਂ ਮੇਰਾ ਐਡਰੈਸ ਮੇਰਾ ਫੋਨ ਸਭ ਕੁਛ ਉਸਨੂੰ ਮੇਰਾ ਪਤਾ ਹੈ ਤਾਂ ਮੈਂ ਪਾਸਵਰਡ ਚੇਂਜ ਕਰਨਾ ਚਾਹੁੰਦਾ ਕ੍ਰਿਪਾ ਕਰਕੇ ਤੁਸੀਂ ਮੈਨੂੰ ਇਹ ਸਮਝਾ ਸਕਦੇ ਹੋ ਕਿ ਮੈਂ ਕਿਵੇਂ ਕਰ ਸਕਦਾ ਹਾਂ ਪਾਸਵਰਡ ਚੇਂਜ ਇਹ ਸਮਝਾਉਣ ਨਾਲ ਮੈਂ ਬਹੁਤ ਹੀ ਵਧੀਆ ਮਹਿਸੂਸ ਕਰਾਂਗਾ ਮੈਨੂੰ ਡਿਜ਼ੀ ਲੋਕਰ ਡੀਜ਼ੀ ਲੋਕਰ ਰਾਹੀਂ ਤਾਂ ਬਹੁਤ ਵਧੀਆ ਡੀਜ਼ੀ ਲੋਕਰ ਐਪ ਤਾਂ ਇੱਕ ਬਹੁਤ ਵਧੀਆ ਐਪ ਹੈ ਜਿਸ ਨਾਲ ਮੈਂ ਆਪਣਾ ਸਭ ਕੁਝ ਡਾਟਾ ਸੇਫ ਰੱਖ ਸਕਦਾ ਹਾਂ ਡੀਜ਼ੀ ਲੋਕਰ ਨਾਲ ਮੈਨੂੰ ਡੀਜ਼ੀ ਲੋਕਰ ਵਿੱਚ ਆਪਣੇ ਪ੍ਰੂਫ ਮੈਨੂੰ ਕਿਤੇ ਵੀ ਚੌਕੀ ਜਾਂ ਥਾਣੇ ਵਾਲੇ ਘੇਰ ਲੈਂਦੇ ਸਹੀ ਤਾਂ ਮੈਂ ਡੀਜ਼ੀ ਲੋਕਰ ਰਾਹੀਂ ਆਪਣਾ ਸਭ ਕੁਝ ਕਰ ਸਕਦਾ ਪਰ ਮੈਨੂੰ ਇੰਨੀ ਉਮੀਦ ਹੈਗੀ ਮੈਨੂੰ ਮੇਰੇ ਦੋਸਤ ਨੇ ਮੇਰੇ ਪ੍ਰੂਫਾਂ ਨੂੰ ਗਲਤ ਇਸਤੇਮਾਲ ਕਰ ਸਕਦਾ ਹੈ ਤਾਂ ਕਰਕੇ ਮੈਂ ਤੁਹਾਨੂੰ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ ਕਿ ਮੇਰੇ ਡੀਜ਼ੀ ਲੋਕਰ ਦਾ ਪਾਸਵਰਡ ਚੇਂਜ ਕਰ ਸਕਾਂ ਮੈਂ ਮੈਨੂੰ ਇਹ ਇਹ ਅੱਠ ਪੰਜ ਚਾਰ ਤਿੰਨ ਦੋ ਨੌ ਇੱਕ 'ਤੇ ਕਾਲ ਕਰਕੇ ਮੈਨੂੰ ਸਮਝਾਇਆ ਜਾ ਸਕੇ ਕਿ ਮੈਂ ਕਿਵੇਂ ਆਪਣਾ ਪਾਸਵਰਡ ਚੇਂਜ ਕਰ ਸਕਦਾ ਹਾਂ ਮੈਨੂੰ ਇਸ ਦੀ ਬਹੁਤ ਜ਼ਰੂਰੀ ਜ਼ਰੂਰਤ ਹੈ ਜ਼ਰੂਰਤ ਹੈ ਕਿਉਂਕਿ ਇਸ ਨੂੰ ਮੈਂ ਛੇਤੀ ਤੋਂ ਛੇਤੀ ਚੇਂਜ ਕਰਨਾ ਚਾਹੁੰਦਾ ਹਾਂ ਮੇਰਾ ਦੋਸਤ ਮੇਰੇ ਡੀਜ਼ੀ ਲੋਕਰ ਨਾਲ ਕੁਛ ਵੀ ਕੋਈ ਵੀ ਛੇੜਖਾਨੀ ਜਾਂ ਕੁਛ ਵੀ ਗਲਤ ਪ੍ਰਯੋਗ ਕਰਕੇ ਕੁਛ ਵੀ ਕਰ ਸਕਦਾ ਹੈ ਉਸ ਨੂੰ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਚੁੱਕੀ ਹੈ ਮੈਂ ਤੁਹਾਡੇ ਕੋਲੋਂ ਮਾਫੀ ਮੰਗਦਾ ਹਾਂ ਆਪ ਜੀ ਦਾ ਧੰਨਵਾਦ ਹੀ ਹੋਵਾਂਗਾ